ਹੈਲੋ ਤੁਸੀਂ ਪੀਜ਼ਾ ਪਲੈਨੇਟ ਤੋਂ ਗੱਲ ਕਰ ਰਹੇ ਆ ਜੀ ਅਸੀਂ ਪੀਜ਼ਾ ਮੰਗਾਇਆ ਸੀ ਜੀ ਨਾਲੇ ਫਰੇਂਸ ਫਰੈਂਚ ਫਰਾਈਜ਼ ਇੱਕ ਠੰਡੇ ਦੀ ਬੋਤਲ ਸੀਗੀ ਸਵੇਰੇ ਔਡਰ ਕੀਤਾ ਸੀ ਹਲੇ ਤੱਕ ਨਹੀਂ ਜੀ ਪਹੁੰਚਿਆ ਬੁੱਢਾ ਭੋਰਾ ਕਿੰਨੀ ਕੁ ਦੂਰ ਹੈ ਜੀ ਬੁੱਢਾ ਭੋਰਾ ਆ ਦੋ ਤਿੰਨ ਕਿਲੋਮੀਟਰ ਤਾਂ ਹੈਗਾ ਹਲੇ ਤੱਕ ਨਹੀਂ ਔਡਰ ਪਹੁੰਚਿਆ ਕਦੋਂ ਤੱਕ ਪਹੁੰਚੇਗਾ ਪਤਾ ਕਰਕੇ ਦੱਸਣਾ ਜ਼ਰਾ ਨਹੀਂ ਫਿਰ ਅਸੀਂ ਆਪਣਾ ਕੈਂਸਲ ਕਰਵਾ ਲਈਏ ਸਾਡੇ ਤਾਂ ਪੈਸੇ ਵੀ ਬੇਕਾਰ ਜਾਣੇ ਆ ਧੰਨਵਾਦ ਜੀ